ਹਾਂਜੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਲਾਈਵ ਬਹੁਤ ਸਾਰੇ ਪੰਜਾਬੀ ਗਾਇਕਾਂ ਨੂੰ ਸੁਣਿਆ ਜਿਨ੍ਹਾਂ ਦੇ ਵਿੱਚੋਂ ਵੀਰ ਬੀਰ ਸਿੰਘ ਜਿਹੜੇ ਪੰਜਾਬ ਦੇ ਪ੍ਰਸਿੱਧ ਲੇਖਕ ਵੀ ਨੇ ਲਿਖਾਰੀ ਨੇ ਗੀਤ ਲਿਖਦੇ ਵੀ ਨੇ ਗੀਤਕਾਰ ਨੇ ਅਤੇ ਗਾਉਂਦੇ ਵੀ ਬਹੁਤ ਸੋਹਣਾ ਨੇ ਉਹਨਾਂ ਦਾ ਲਾਈਵ ਸੁਣ ਕੇ ਰੂਹ ਨੂੰ ਸਕੂਨ ਵੀ ਮਿਲਿਆ ਬੜਾ ਆਨੰਦ ਬਣਿਆ ਕਿਉਂਕਿ ਉਹ ਰੂਹ ਤੋਂ ਗਾਉਂਦੇ ਨੇ ਉਹ ਉਸ ਢੰਗ ਦਾ ਸੰਗੀਤ ਨਹੀਂ ਪ੍ਰਚਾਰ ਦੇ ਪ੍ਰਸਾਰ ਦੇ ਜਿਹੜਾ ਰੂਹ ਨੂੰ ਸਕੂਨ ਨਾ ਦੇਵੇ ਉਹਨਾਂ ਦੀ ਗਾਇਕੀ ਉਹਨਾਂ ਦੀ ਗੀਤਕਾਰੀ ਦੇ ਵਿੱਚ ਇੱਕ ਵੱਖਰੇ ਜੀ ਕਿਸਮ ਦਾ ਆਨੰਦ ਹੈ ਖੇੜਾ ਵਾ ਅਤੇ ਸਕੂਨ ਆ ਅਤੇ ਉਹ ਜਦੋਂ ਗਾਉਂਦੇ ਨੇ ਕਿਉਂਕਿ ਇੱਕ ਤਾਂ ਉਹਨਾਂ ਦੀ ਦਿੱਖ ਅਧਿਆਤਮਿਕ ਆ ਦੂਸਰਾ ਜਦੋਂ ਵੀ ਉਹ ਗਾਉਂਦੇ ਨੇ ਗਾਉਂਦੇ ਵੀ ਫਿਰ ਬੜੀਆਂ ਗੁੱਝੀਆਂ ਅਤੇ ਡੂੰਘੀਆਂ ਗੱਲਾਂ ਨੇ ਜਿਹਦੇ ਕਰਕੇ ਮੈਨੂੰ ਉਹਨਾਂ ਦਾ ਲਾਈਵ ਕਾਫ਼ੀ ਵਧੀਆ ਲੱਗਾ ਔਰ ਲਾਈਵ ਵੀ ਬਹੁਤ ਸੋਹਣੇ ਢੰਗ ਦੇ ਨਾਲ ਆਪਣਾ ਨਿਭਾਉਂਦੇ ਨੇ ਅਤੇ ਮੈਂ ਪਸੰਦ ਕਰਾਂਗਾ ਅੱਗੇ ਵੀ ਜਦੋਂ ਕਿਤੇ ਵੀਰ ਬੀਰ ਸਿੰਘ ਨੂੰ ਲਾਈਵ ਸੁਣਨ ਦਾ ਮੌਕਾ ਮਿਲੇ ਤਾਂ ਮੈਂ ਜ਼ਰੂਰ ਸੁਣੂਗਾ ਜ਼ਰੂਰ ਜਾਵਾਂਗਾ ਇਸ ਤਰੀਕੇ ਦੇ ਨਾਲ ਡਾਕਟਰ ਸਤਿੰਦਰ ਸਰਤਾਜ ਸਿੰਘ ਦਾ ਵੀ ਲਾਈਵ ਬਹੁਤ ਪਿਆਰਾ ਹੁੰਦਾ ਬਹੁਤ ਸੋਹਣੀ ਗਾਇਕੀ ਆ ਵੀਰ ਰਣਜੀਤ ਸਿੰਘ ਬਾਵਾ ਉਹ ਵੀ ਬਹੁਤ ਸੋਹਣਾ ਗਾਉਂਦੇ ਨੇ ਲਾਈਵ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਸਿੰਗਰ ਨੇ ਨੌਜਵਾਨ ਸਾਡੇ ਅੱਜ ਦੇ ਨਵੇਂ ਜਿਹਨਾਂ ਨੂੰ ਲਾਈਵ ਸੁਣਨ ਦਾ ਮੌਕਾ ਵੀ ਮਿਲਿਆ ਬਹੁਤ ਸੋਹਣਾ ਲਾਈਵ ਗਾਉਂਦੇ ਨੇ